ਇੰਟਰਨੈਟ ਨੇ ਬੈਂਕਿੰਗ ਅਤੇ ਲੈਣ ਦੇਣ ਦਾ ਤਰੀਕਾ ਬਦਲ ਦਿੱਤਾ ਹੈ ਅੱਜ ਕੱਲ੍ਹ ਇੰਟਰਨੈਟ ਦੇ ਜ਼ਰੀਏ ਹਰ ਇੱਕ ਕੰਮ ਇੱਕ ਥਾਂ 'ਤੇ ਬੈਠ ਕੇ ਕੀਤਾ ਜਾ ਸਕਦਾ ਹੈ ਪਹਿਲਾਂ ਹਰ ਇੱਕ ਕੰਮ ਕਰਨ ਦੇ ਲਈ ਬੈਂਕ ਜਾਣਾ ਜ਼ਰੂਰੀ ਹੁੰਦਾ ਸੀ ਪਰ ਅੱਜ ਕੱਲ੍ਹ ਇੱਕ ਬੰਦਾ ਜੇਕਰ ਮਾਨਸਾ ਹੈ ਤਾਂ ਉਹਨੇ ਪਟਿਆਲੇ ਪੈਸੇ ਭੇਜਣੇ ਹਨ ਤਾਂ ਉਹ ਗੂਗਲ ਪੇ ਪੇਟੀਐਮ ਦੇ ਰਾਹੀਂ ਕਿਤੇ ਵੀ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ ਇੰਟਰਨੈਟ ਨੇ ਹਰ ਇੱਕ ਦਾ ਕੰਮ ਸੌਖਾ ਕਰ ਦਿੱਤਾ ਹੈ ਅਤੇ ਸਮੇਂ ਦੀ ਬੱਚਤ ਕਰਨ ਬਾਰੇ ਦੱਸਿਆ ਹੈ ਇਹ ਇੰਟਰਨੈਟ ਨੇ ਹੋਰ ਵੀ ਬਹੁਤ ਜ ਸਾਰੀਆਂ ਸੁਵਿਧਾਵਾਂ ਦਿੱਤੀਆਂ ਨੇ ਇੰਟਰਨੈਟ ਦੇ ਭਰੋਸਾ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇੰਟਰਨੈਟ ਦੇ ਰਾਹੀਂ ਕਿਸੇ ਨੂੰ ਵੀ ਕੋਈ ਪੈਸਾ ਟਰਾਂਸਫਰ ਕਰਨਾ ਹੈ ਤਾਂ ਉਸਦਾ ਰਿਕੋਡ ਵੀ ਇਸ ਵਿੱਚ ਰੱਖਿਆ ਜਾਂਦਾ ਹੈ ਅਤੇ ਇੰਟਰਨੈਟ ਦੇ ਰਾਹੀਂ ਕੋਈ ਵੀ ਕਿਸੇ ਵੀ ਕਿੰਨਾ ਵਿਦੇਸ਼ਾਂ ਦੇ ਵਿੱਚ ਕੋਈ ਵੀ ਪੈਸਾ ਕਦੋਂ ਵੀ ਟਰਾਂਸਫਰ ਕਰ ਸਕਦਾ ਹੈ ਇੰਟਰਨੈਟ ਇੱਕ ਬਹੁਤ ਹੀ ਚੰਗੀ ਸੁਵਿਧਾ ਹੈ ਪਹਿਲਾਂ ਹਰ ਇੱਕ ਕੰਮ ਕਰਨ ਦੇ ਲਈ ਬੈਂਕ ਦੇ ਵਿੱਚ ਜਾਣਾ ਜ਼ਰੂਰੀ ਹੁੰਦਾ ਸੀ ਪਰ ਅੱਜ ਕੱਲ੍ਹ ਇੰਟਰਨੈਟ ਦੇ ਰਾਹੀਂ ਬੈਂਕ ਰਾਹੀਂ ਜਾਣਾ ਜ਼ਰੂਰੀ ਨਹੀਂ ਹੁੰਦਾ ਇੰਟਰਨੈਟ ਦੇ ਰਾਹੀਂ ਘਰ ਬੈਠੇ ਹੀ ਹਰ ਇੱਕ ਕੰਮ ਸਫਲਤਾਪੂਰਵਕ ਹੋ ਜਾਂਦਾ ਹੈ ਅਤੇ ਹਰ ਇੱਕ ਕੰਮ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰਿਆ ਜਾ ਸਕਦਾ ਹੈ